ਹੈਲੋ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਬੋਲਦੇ ਹੋ ਸਤਿ ਸ਼੍ਰੀ ਅਕਾਲ ਜੀ ਮੈਂ ਮਤਲਬ ਅਸੀਂ ਪੁੱਛਣਾ ਚਾਹੁੰਦੇ ਹਾਂ ਤੁਹਾਨੂੰ ਵੀ ਅੱਜ ਕੱਲ੍ਹ ਮਤਲਬ ਵੀ ਜਿਵੇਂ ਫਸਲਾਂ ਬੀਜੀਆਂ ਜਿਹੜੀਆਂ ਕੋਈ ਵੱਢਣ ਵਾਲੀਆਂ ਜਾਂ ਕਿਵੇਂ ਹਾਂ ਅਤੇ ਆਂ ਉਹਨਾਂ ਦੇ ਮਤਲਬ ਜਿਹੜੀਆਂ ਬੀਜਣ ਵਾਲੀਆਂ ਫਸਲਾਂ ਉਹਨਾਂ ਦੇ ਬੀਜਾਂ ਬਾਰੇ ਪੁੱਛਣਾ ਸੀ

ਹਾਂ ਅਤੇ ਉਹਨਾਂ ਦੇ ਮਤਲਬ ਆਪਾਂ ਨੂੰ ਬੀਜ ਜਿਹੜੇ ਵਧੀਆ ਬੀ ਮਿਲ ਸਕਦੇ ਅਤੇ ਕਿਹੜੇ ਕਿਹੜੇ ਬੀਜ ਜਿਹੜੇ ਮੌਸਮ ਅਨੁਸਾਰ ਮਤਲਬ ਹੁਣ ਬੀਜਾਂਗੇ ਹੁਣ ਮੇਰੀ ਕਣਕ ਦੀ ਨਹੀਂ ਜੋ ਆਪਾਂ ਬਿਜਾਈ ਕਰਨੀ ਹੁਣ ਕਣਕ ਦੀ ਬਿਜਾਈ ਆ ਕਣਕ ਬੀਜਣੀ ਹੈ ਅਤੇ ਉਹਦਾ ਬੀਜ ਲੈਣਾ ਘਰੋਂ ਵੀ ਅੱਛਾ ਅੱਛਾ ਅੱਛਾ ਹਾਂ ਹਾਂ ਹਾਂ ਤੇਲ ਕਢਵਾਉਂਦੇ ਆ ਹਾਂਜੀ

ਅੱਛਾ ਇੱਕ ਸੂਰਜਮੁਖੀ ਵੀ ਚੱਲਦੀ ਹੈ ਨਾ ਸੂਰਜਮੁਖੀ ਦਾ ਸੂਰਜਮੁਖੀ ਦੇ ਬੀਜ ਅੱਛਾ ਅੱਛਾ ਅੱਛਾ ਅ ਵੀ ਸਾਨੂੰ ਵੀ ਅਸੀਂ ਪੁੱਛਦੇ ਸੀ ਚੱਲ ਤੁਹਾਡੇ ਕੋਲੋਂ ਜਿਹੜੇ ਵਧੀਆ ਬੀਜ ਸਾਨੂੰ ਮਿਲ ਸਕਣ ਅਤੇ ਅਸੀਂ ਵੀ ਹੁਣ ਕਣਕ ਬੀਜਣੀ ਹੈ ਤੁਸੀਂ ਕਣਕ ਦਾ ਬੀਜ ਅਸੀਂ ਲੈਣਾ ਤੁਹਾਡੇ ਕੋਲੋਂ ਅਤੇ ਸਰ੍ਹੋਂ ਦਾ ਵੀ ਸਰ੍ਹੋਂ ਦਾ ਵੀ ਲੈਣਾ ਹਾਂਜੀ ਅੱਛਾ ਹੁੰ ਠੀਕ ਹੈ ਹਾਂ ਕੋਈ ਨਹੀਂ ਜੀ ਠੀਕ ਆ ਜੀ ਚੱਲ ਅੱਛਾ ਜੀ